ਅਜੋਕੇ ਵਾਤਾਵਰਨ ਦੇ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੋਗੇ ਜੇ ਦੇਖਿਆ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਧਰਤੀ ਪੰਜ ਤੱਤਾਂ ਤੋਂ ਬਣੀ ਹੈ ਅਤੇ ਉਹ ਪੰਜ ਦੇ ਪੰਜ ਤੱਤ ਹੀ ਮਨੁੱਖੀ ਸੱਭਿਅਤਾ ਨੇ ਤਹਿਸ ਨਹਿਸ ਕਰਕੇ ਕੇ ਰੱਖ ਦਿੱਤੇ ਹਨ ਜੇਕਰ ਅਸੀਂ ਇਨ੍ਹਾਂ ਪੰਜਾਂ ਤੱਤਾਂ ਹਵਾ ਪਾਣੀ ਅਕਾਸ਼ ਮਿੱਟੀ ਅਤੇ ਵਾਯੂ ਨੂੰ ਨਾ ਸੰਭਾਲ ਸਕੇ ਤਾਂ ਇਹ ਮਨੁੱਖੀ ਹੋਂਦ 'ਤੇ ਹੀ ਇੱਕ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦੇਵੇਗੀ ਕਿਉਂਕਿ ਇਸ ਦਾ ਸਿੱਧਾ ਜਾਂ ਅਸਿੱਧਾ ਮਨੁੱਖ 'ਤੇ ਹੀ ਪ੍ਰਭਾਵ ਪਵੇਗਾ